ਮੈਂ ਸਤਿੰਦਰ ਸਰਤਾਜ ਨੂੰ ਲਾਈਵ ਸੁਣਿਆ ਹੈ ਜੋ ਕੀ ਇੱਕ ਬਹੁਤ ਹੀ ਵਧੀਆ ਸੰਗੀਤਕਾਰ ਹੈ ਉਹ ਸੋਸ਼ੇਬਾਜ਼ੀ ਨਹੀਂ ਕਰਦਾ ਉਹ ਫੁਕਰੀ ਨਹੀਂ ਮਾਰਦਾ ਉਹ ਆਪਣੇ ਆਲੇ ਦੁਆਲੇ ਅਤੇ ਸੱਭਿਆਚਾਰ ਬਾਰੇ ਹੀ ਗਾਉਂਦਾ ਹੈ ਜਿਸਨੂੰ ਸੁਣ ਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਉਸਦੇ ਗਾਣੇ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਉਸਦੇ ਗਾਣੇ ਬਹੁਤ ਸਾਰੇ ਲੋਕੀ ਪਸੰਦ ਕਰਦੇ ਹਨ ਜੇਕਰ ਮੈਂ ਕਿਸੇ ਗਾਇਕ ਕਿਸੇ ਹੋਰ ਗਾਇਕ ਨੂੰ ਲਾਈਵ ਸੁਣਨਾ ਚਾਵਾਂ ਤਾਂ ਮੈਂ ਨਿਮਰਤ ਖਹਿਰਾ ਨੂੰ ਸੁਣਨਾ ਚਾਹੂੰਗੀ ਕਿਉਂਕਿ ਉਹ ਇੱਕ ਬਹੁਤ ਹੀ ਵਧੀਆ ਸੰਗੀਤਗਾਰਾਂ ਵਿੱਚੋਂ ਇੱਕ ਹੈ ਜੋ ਕੀ ਵੀ ਬਹੁਤ ਵਧੀਆ ਗਾਉਂਦੀ ਹੈ ਅਤੇ ਉਸਦੀ ਆਵਾਜ਼ ਵੀ ਬਹੁਤ ਸੁਰੀਲੀ ਹੈ